ਭੰਗੜਾ ਪੰਜਾਬ ਦੀ ਸ਼ਾਨ ਹੈ ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਭੰਗੜਾ ਪੰਜਾਬ ਦੀ ਸ਼ਾਨ ਨੂੰ ਵਧਾਉਂਦਾ ਹੈ ਭੰਗੜਾ ਸਕੂਲਾਂ ਅਤੇ ਕਾਲਜਾਂ ਦੋਹਾਂ ਵਿੱਚ ਕਰਵਾਇਆ ਜਾਂਦਾ ਹੈ ਭੰਗੜੇ ਨੂੰ ਮੁੰਡੇ ਅਤੇ ਕੁੜੀਆਂ ਦੋਹਾਂ ਦੁਆਰਾ ਕਰਵਾਇਆ ਜਾਂਦਾ ਹੈ ਮੁੰਡਾ ਕੁੜਤਾ ਪਜਾਮਾ ਪਾ ਕੇ ਇਸ ਦੀ ਸ਼ਾਨ ਨੂੰ ਵਧਾਉਂਦੇ ਹਨ ਅਤੇ ਕੁੜੀਆਂ ਲਹਿੰਗਾਂ ਚੋਲੀ ਪਾ ਕੇ ਭੰਗੜੇ ਦੀ ਸ਼ਾਨ ਨੂੰ ਵਧਾਉਂਦੀਆਂ ਹਨ ਮੁੰਡੇ ਪੱਗਾਂ ਪਾ ਕੇ ਭੰਗੜੇ ਦੀ ਸ਼ਾਨ ਨੂੰ ਵਧਾਉਂਦੇ ਹਨ ਅਤੇ ਕੁੜੀਆਂ ਪਰਾਂਦੇ ਪਾ ਕੇ ਭੰਗੜੇ ਦੀ ਸ਼ਾਨ ਨੂੰ ਵਧਾਉਂਦੀਆਂ ਹਨ ਪੰਜਾਬ ਵਿੱਚ ਇਸ ਨੂੰ ਵਿਆਹਾਂ ਸ਼ਾਦੀਆਂ ਵਿੱਚ ਵੀ ਕਰਵਾਇਆ ਜਾਂਦਾ ਹੈ ਭੰਗੜੇ ਨਾਲ ਵਿਆਹਾਂ ਵਿੱਚ ਬਹੁਤ ਰੌਣਕ ਲੱਗ ਜਾਂਦੀ ਹੈ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 ਇਹ ਲੋਹੜੀ ਅਤੇ ਵਿਸਾਖੀ ਵਰਗੇ ਤਿਉਹਾਰਾਂ 'ਤੇ ਕੀਤਾ ਜਾਂਦਾ ਹੈ ਭੰਗੜਾ ਮੁੰਡੇ ਅਤੇ ਕੁੜੀਆਂ ਬਹੁਤ ਪਸੰਦ ਕਰਦੇ ਹਨ ਸਕੂਲਾਂ ਕਾਲਜਾਂ ਵਿੱਚ ਬੱਚੇ ਕੋਈ ਵੀ ਫੰਕਸ਼ਨ ਹੁੰਦਾ ਆ ਤਾਂ ਹਿੱਸਾ ਲੈਣਾ ਪਸੰਦ ਕਰਦੇ ਆ ਭੰਗੜੇ ਵਿੱਚ ਧੰਨਵਾਦ ਜੀ